ਵੈਸੇ ਤਾਂ ਮੈਨੂੰ ਘੁੰਮਣ ਦਾ ਬਹੁਤ ਜ਼ਿਆਦਾ ਸ਼ੌਂਕ ਹੈਗਾ ਹੈ ਮੈਂ ਅਕਸਰ ਹੀ ਜਿੱਦਾਂ ਵੀ ਛੁੱਟੀਆਂ ਵਗੈਰਾ ਹੁੰਦੀਆਂ ਹੈ ਜਾਂ ਮੈਂ ਕਦੇ ਵੀ ਵੀਕਐਂਡ ਵਗੈਰਾ 'ਤੇ ਜੇ ਵੀਕਐਂਡ ਵਗੈਰਾ ਹੋਵੇ ਤਾਂ ਮਤਲਬ ਮੈਂ ਮਾੜਾ ਮੋਟਾ ਨੇੜੇ ਤੇੜੇ ਜਾਂ ਫਿਰ ਜੇ ਕੋਈ ਹੋਰ ਛੁੱਟੀਆਂ ਹੋਵੇ ਜਿੱਦਾਂ ਗਰਮੀਆਂ ਦੀਆਂ ਛੁੱਟੀਆਂ ਹੋ ਗਈਆਂ ਉਹਦੇ ਵਿੱਚ ਮੈਂ ਮੈਨੂੰ ਪਹਾੜਾਂ ਵੱਲ ਸਪੈਸ਼ਲੀ ਠੰਢੀਆਂ ਥਾਵਾਂ 'ਤੇ ਘੁੰਮਣਾ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਦਾ ਹੈਗਾ ਹੈ ਕਿਉਂਕਿ ਇੱਕ ਤਾਂ ਜਿੱਦਾਂ ਹੁਣ ਸਾਡੇ ਵੱਲ ਗਰਮੀ ਹੁੰਦੀ ਹੈਗੀ ਹੈ ਪੰਜਾਬ 'ਚ ਗਰਮੀ ਹੁੰਦੀ ਕਈ ਇਸ ਤੋਂ ਇਲਾਵਾ ਇੱਦਾਂ ਹੁਣ ਬੰਦਾ ਹਿਮਾਚਲ ਵੱਲ ਨੂੰ ਲੰਘ ਜਾਂਦਾ ਹੈਗਾ ਹੈ ਉੱਧਰ ਥੋੜ੍ਹੀ ਠੰਡ ਹੁੰਦੀ ਹੈਗੀ ਇੱਕ ਤਾਂ ਵੀ ਮੌਸਮ ਵੀ ਚੇਂਜ ਹੋ ਜਾਂਦਾ ਹੈਗਾ ਹੈ ਅਤੇ ਉਸ ਤੋਂ ਇਲਾਵਾ ਬੰਦੇ ਦਾ ਵੀ ਉਦਾਂ ਵੀ ਫਰੈਸ਼ ਜਿਹਾ ਫੀਲ ਕਰਦਾ ਵਧੀਆ ਵਧੀਆ ਫੀਲ ਹੁੰਦਾ ਹੈਗਾ ਹੈ ਇਸ ਕਰਕੇ ਜਿੱਦਾਂ ਹੁਣ ਪਿੱਛਾ ਜਿਹੇ ਆਪਾਂ ਹੇਮਕੁੰਟ ਸਾਹਿਬ ਗਏ ਸੀਗੇ ਪਹਿਲਾਂ ਤਾਂ ਮੈਨੂੰ ਮਤਲਬ ਇੱਕ ਥੋੜ੍ਹਾ ਚੜ੍ਹਾਈ ਵਗੈਰਾ 'ਤੇ ਜ਼ਿਆਦਾ ਚੜ੍ਹਾਈ 'ਤੇ ਥੋੜ੍ਹਾ ਬਹੁਤਾ ਡਰ ਲੱਗਦਾ ਤਾ ਅਤੇ ਮੈਨੂੰ ਉਹਦੇ ਵਿੱਚ ਕਾਫ਼ੀ ਜ਼ਿਆਦਾ ਮਤਲਬ ਕਦੇ ਕਦੇ ਉਲਟੀਆਂ ਵਗੈਰਾ ਵੀ ਲੱਗ ਜਾਂਦੀਆਂ ਤੀਆਂ ਤਾਂ ਇਸ ਕਰਕੇ ਮੈਂ ਜਿੱਦਾਂ ਹੁਣ ਜਿੱਦਾਂ ਹੀ ਹੇਮਕੁੰਟ ਸਾਹਿਬ ਅਸੀਂ ਗਏ ਹੈਗੇ ਆ ਉੱਧਰ ਉੱਧਰ ਕਾਫ਼ੀ ਜ਼ਿਆਦਾ ਤੇ ਮਤਲਬ ਗੋਬਿੰਦ ਘਾਟ ਤੋਂ ਉੱਪਰ ਹੇਮਕੁੰਟ ਸਾਹਿਬ ਗੁਰਦੁਆਰਾ ਸਾਹਿਬ ਤੱਕ ਤੁਰ ਕੇ ਜਾਣਾ ਪੈਂਦਾ ਸੀਗਾ ਤਾਂ ਉਹ ਉਹਦੇ ਵਿੱਚ ਕਾਫ਼ੀ ਜ਼ਿਆਦਾ ਇੱਕ ਤਾਂ ਮਤਲਬ ਤੁਰ ਕੇ ਜਾਣ ਨੂੰ ਵੀ ਰਾਸਤਾ ਕਾਫ਼ੀ ਹੈਗਾ ਜਿਹੜਾ ਗੋਬਿੰਦ ਘਾਟ ਤੋਂ ਉੱਪਰ ਤੱਕ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਆਉਣਾ ਜਾਣਾ ਸਾਰਾ ਇੱਕ ਦਿਨ 'ਚ ਕਰਨਾ ਪੈਂਦਾ ਹੈਗਾ ਹੈ ਅਤੇ ਇਹਦੇ ਨਾਲ ਕਿਆ ਹੁੰਦਾ ਹੈਗਾ ਉੱਥੇ ਨੇ ਬੰਦੇ ਨੂੰ ਢਾਂਗੂ ਵਗੈਰਾ ਜਾਂ ਡਾਂਗ ਵਗੈਰਾ ਜਾਂ ਇੱਕ ਲਾਠੀ ਵਗੈਰਾ ਲੈ ਕੇ ਨਾਲ ਚੱਲਣਾ ਪੈਂਦਾ ਹੈਗਾ ਇੱਕ ਮਾੜਾ ਮੋਟਾ ਸਮਾਨ ਵੀ ਹੁੰਦਾ ਹੈਗਾ ਬੰਦੇ ਕੋਲ ਹੈਂ ਮਾੜਾ ਮੋਟਾ ਖਾਣ ਪੀਣ ਦਾ ਉਹ ਵਗੈਰਾ ਨਾਲ ਲੈ ਕੇ ਚੱਲਣਾ ਪੈਂਦਾ ਹੈਗਾ ਹੈ ਅਤੇ ਇਸ ਕਰਕੇ ਜਿਹੜਾ ਪਹਿਲਾਂ ਤਾਂ ਮੈਨੂੰ ਡਰ ਲੱਗਦਾ ਤਾ ਬਈ ਹਾਂ ਬਈ ਮੈਂ ਹੁਣ ਜੇ ਕਿਤੇ ਫਿਸਲ ਗਿਆ ਮੈਂ ਖਾਈ 'ਚ ਗਿਰ ਜਾਣਾ ਹੈਗਾ ਹੈ ਤਾਂ ਮੇਰੇ ਦੋਸਤਾਂ ਨੇ ਜਿਹੜੇ ਮੇਰੇ ਨਾਲ ਸਾਥੀ ਗਏ ਤੇ ਮੇਰੇ ਉਹਨੀ ਮੈਨੂੰ ਮਤਲਬ ਇੱਕ ਤਰ੍ਹਾਂ ਕਹਿ ਲਓ ਮੈਨੂੰ ਹੱਲਾਸ਼ੇਰੀ ਦਿੱਤੀ ਪੰਪ ਛਕਾਏ ਕੁਛ ਵੀ ਕਹਿ ਲਓ ਵੀ ਉਹਨੀ ਮੈਨੂੰ ਉਹ ਪੂਰੀ ਹੱਲਸ਼ੇਰੀ ਦਿੱਤੀ ਮੈਨੂੰ ਐਨ ਪੂਰਾ ਮੋਟੀਵੇਟ ਕੀਤਾ ਵੀ ਕੁਛ ਨਹੀਂ ਹੋਣ ਲੱਗਾ ਸੀ ਤੇਰੇ ਨਾਲ ਹੈ ਹੈਂ ਵੀ ਜੋ ਵੀ ਹੋਇਆ ਅਸੀਂ ਦੇਖ ਲਾਂਗੇ ਤੇਰੇ ਨਾਲ ਵੀ ਇਸ ਤਰ੍ਹਾਂ ਮੈਨੂੰ ਕਾਫ਼ੀ ਜ਼ਿਆਦਾ ਹੱਲਾਸ਼ੇਰੀ ਦਿੱਤੀ ਅਤੇ ਮੇਰਾ ਹੌਸਲਾ ਵੀ ਖੁੱਲ੍ਹ ਗਿਆ ਅਤੇ ਮੈਂ ਉੱਥੇ ਮਤਲਬ ਵਧੀਆ ਢੰਗ ਨਾਲ ਹੁਣ ਮੈਂ ਜੇ ਮੈਂ ਇਕੱਲਾ ਵੀ ਜਾਣ ਨੂੰ ਕਹਿ ਦਿਓ ਮੈਂ ਹੇਮਕੁੰਟ ਸਾਹਿਬ ਇਕੱਲਾ ਵੀ ਜਾ ਸਕਦਾ ਹੈਗਾ ਹੈ ਅਤੇ ਮੇਰਾ ਐਕਸਪੀਰੀਸ ਬਹੁਤ ਜ਼ਿਆਦਾ ਵਧੀਆ ਰਿਹਾ